ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਹੈ ਅਸੀਂ ਬਚਪਨ ਤੋਂ ਹੀ ਪੰਜਾਬੀ ਸਿੱਖੀ ਹੈ ਪੰਜਾਬੀ ਬੋਲੀ ਹੈ ਪੰਜਾਬੀ ਲਿਖੀ ਹੈ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਹੀ ਲਿਖੀ ਹੈ ਪੰਜਾਬੀ ਬੋਲੀ ਹੈ ਔਰ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਹੈ ਪੰਜਾਬ ਦੀ ਜਿਹੜੀ ਭਾਸ਼ਾ ਹੈ ਇਹ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬੜੀ ਮੰਨੀ ਜਾਂਦੀ ਹੈ ਜਦੋਂ ਕੋਈ ਪੰਜਾਬੀ ਵਿਅਕਤੀ ਪੰਜਾਬ ਤੋਂ ਬਾਹਰਲੇ ਕਿਸੇ ਰਾਜ ਵੀ ਜਾਂਦਾ ਕਿਸੇ ਦੇਸ਼ ਵਿੱਚ ਜਾਂਦਾ ਤਾਂ ਉੱਥੇ ਉਹਦੀ ਬਹੁਤ ਇੱਜ਼ਤ ਉਹਦਾ ਮਾਣ ਸਤਿਕਾਰ ਕੀਤਾ ਜਾਂਦਾ ਔਰ ਉਹਨੂੰ ਪਹਿਲ ਦੇ ਤੌਰ ਤੇ ਉਹਦਾ ਬਣਦਾ ਸਨਮਾਨ ਵੀ ਕੀਤਾ ਜਾਂਦਾ ਹੈ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਪੰਜਾਬੀਆਂ ਦੀ ਬੜੀ ਇੱਜ਼ਤ ਕੀਤੀ ਜਾਂਦੀ ਹੈ ਸਾਨੂੰ ਪੰਜਾਬੀ ਬੋਲ ਕੇ ਪੰਜਾਬੀ ਲਿਖ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਕਿਉਂਕੀ ਜਿਹੜੀ ਪੰਜਾਬੀ ਭਾਸ਼ਾ ਹੈ ਇਹਦੇ ਪ੍ਰਤੀ ਬਹੁਤ ਸਾਰੇ ਲੇਖਕਾਂ ਨੇ ਬਹੁਤ ਸਾਰੇ ਕਵਿਤਾਵਾਂ ਲੇਖ ਆਰਟੀਕਲ ਲਿਖੇ ਨੇ ਔਰ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਦਾ ਜਿਹੜਾ ਮਹੱਤਵ ਹੈ ਉਹ ਬਹੁਤ ਡੂੰਘਾ ਦੱਸਿਆ ਗਿਆ ਪੰਜਾਬੀ ਦੇ ਵਿੱਚ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਗਈ ਹੈ ਮੈਨੂੰ ਮਾਣ ਹੈ ਪੰਜਾਬੀ ਹੋਣ ਦਾ